ਇਹ ਗੱਲ ਅਕਸਰ ਹੀ ਸੁਣਨ ਨੂੰ ਆਉਂਦੀ ਹੈ ਕਿ ਜਦੋਂ ਅਸੀਂ ਕਿਸੇ ਨੂੰ ਉਧਾਰ ਦਿੰਦੇ ਹਾਂ ਤਾਂ ਰਾਜਾ ਬਣ ਕੇ ਦਿੰਦੇ ਹਾਂ ਪਰੰਤੂ ਜਦੋਂ ਉਹ ਉਧਾਰ ਲਿਆ ਪੈਸਾ ਵਾਪਸ ਲੈਣਾ ਹੁੰਦਾ ਹੈ ਤਾਂ ਸਾਨੂੰ ਭਿਖਾਰੀ ਵਜੋਂ ਉਸ ਬੰਦੇ ਅੱਗੇ ਪੇਸ਼ ਹੋਣਾ ਪੈਂਦਾ ਹੈ ਇਹ ਸਮੀਕਰਨ ਬਿਲਕੁਲ ਉਲਟ ਹੋ ਜਾਂਦੀ ਹੈ ਪਹਿਲਾਂ ਤਾਂ ਅਸੀਂ ਰਾਜੇ ਹੁੰਦੇ ਹਾਂ ਅਤੇ ਬਾਅਦ ਵਿੱਚ ਅਸੀਂ ਭਿਖਾਰੀ ਬਣ ਕੇ ਉਸ ਤੋਂ ਵਾਰ ਵਾਰ ਪੈਸੇ ਮੰਗਦੇ ਹਾਂ ਅਤੇ ਉਹ ਸਾਨੂੰ ਬੰਦਾ ਪੈਸੇ ਨਹੀਂ ਦਿੰਦਾ ਅਜਿਹਾ ਹੀ ਮਸਲਾ ਮੇਰੇ ਨਾਲ ਹੋਇਆ ਸੀ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਤਕਰੀਬਨ ਪੰਜਾਹ ਹਜ਼ਾਰ ਰੁੁੁਪਇਆ ਨਗਦ ਹੱਥੀਂ ਆਪਣੇ ਦਿੱਤਾ ਸੀ ਪਰੰਤੂ ਉਹਨਾਂ ਨੇ ਮੇਰੇ ਤੋਂ ਮੋਹਲਤ ਮੰਗੀ ਕਿ ਅਸੀਂ ਤਕਰੀਬਨ ਦੋ ਮਹੀਨੇ ਦੇ ਅੰਦਰ ਅੰਦਰ ਹੀ ਤੇਰਾ ਪੈਸਾ ਵਾਪਸ ਕਰ ਦਿਆਂਗੇ ਦੋ ਮਹੀਨੇ ਤੱਕ ਮੈਂ ਉਹਨਾਂ ਦਾ ਇੰਤਜ਼ਾਰ ਕੀਤਾ ਕਿ ਸਮਾਂ ਨਿਯਤ ਕਰ ਲਿਆ ਗਿਆ ਸੀ ਕਿ ਦੋ ਮਹੀਨੇ ਦੇ ਅੰਦਰ ਅੰਦਰ ਹੀ ਇਹ ਪੈਸੇ ਵਾਪਸ ਮੋੜ ਦਿੱਤੇ ਜਾਣਗੇ ਇਸ ਗੱਲ ਦਾ ਲਿਖਤੀ ਪ੍ਰਮਾਣ ਤਾਂ ਕੋਈ ਨਹੀਂ ਲਿਆ ਪਰੰਤੂ ਫਿਰ ਵੀ ਮੇਰੇ ਪਰਿਵਾਰ ਦੇ ਮੈਂਬਰ ਉਸ ਸਮੇਂ ਸ਼ਾਮਿਲ ਸਨ ਅਤੇ ਮੈਂ ਉਹਨਾਂ ਨਾਲ ਇਹ ਗੱਲ ਕਰ ਚੁੱਕਿਆ ਸੀ ਅਤੇ ਉਸ ਉਹਨਾਂ ਨੇ ਇਸ ਗੱਲ ਦੀ ਹਾਮੀ ਭਰ ਦਿੱਤੀ ਸੀ ਕਿ ਤੂੰ ਪੈਸੇ ਉਹਨਾਂ ਨੂੰ ਪੁੱਜਦੇ ਕਰ ਦੇ ਪਰੰਤੂ ਦੋ ਮਹੀਨੇ ਦੇ ਬਾਅਦ 'ਚ ਜਦੋਂ ਮੈਨੂੰ ਆਪਣਾ ਕੋਈ ਜ਼ਰੂਰੀ ਕੰਮ ਨੇਪਰੇ ਚਾੜ੍ਹਨ ਲਈ ਪੈਸਿਆਂ ਦੀ ਜ਼ਰੂਰਤ ਪਈ ਤਾਂ ਮੇਰੇ ਰਿਸ਼ਤੇਦਾਰਾਂ ਨੇ ਉਹ ਪੈਸੇ ਦੇਣ ਤੋਂ ਇਨਕਾਰ ਇਸ ਗੱਲ ਕਰਕੇ ਕਰ ਦਿੱਤਾ ਕਿ ਸਾਡੇ ਕੋਲ ਪੈਸੇ ਨਹੀਂ ਹਨ ਸਾਡੇ ਕੋਲ ਆਮਦਨੀ ਦਾ ਕੋਈ ਸਾਧਨ ਨਹੀਂ ਹੈ ਪਰੰਤੂ ਇਸ ਵਿੱਚ ਮੇਰੀ ਕੋਈ ਇਸ ਵਿੱਚ ਮੇਰੀ ਮੈਨੂੰ ਮੁਸੀਬਤ ਪੇਸ਼ ਹੁੰਦੀ ਸੀ ਮੈਂ ਉਹਨਾਂ ਨਾਲ ਬਹੁਤ ਤਰਲੇ ਮਿੰਨਤਾਂ ਕੀਤੀਆਂ ਪਰੰਤੂ ਉਹਨਾਂ ਨੇ ਮੇਰੇ ਪੈਸੇ ਨਹੀਂ ਮੋੜੇ ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਮੋਹਲਤ ਲੈਣੀ ਚਾਹੁੰਦੇ ਹੋ ਤਾਂ ਤੁਸੀਂ ਮੋਹਲਤ ਵੀ ਲੈ ਸਕਦੇ ਹੋ ਉਹਨਾਂ ਨੇ ਮੇਰੇ ਤੋਂ ਤਕਰੀਬਨ ਵੀਹ ਦਿਨ ਦੀ ਮੋਹਲਤ ਹੋਰ ਲੈ ਲਈ ਅਤੇ ਮੈਨੂੰ ਇਹ ਆਸਵਾਸ਼ਨ ਦੁਆਇਆ ਗਿਆ ਕਿ ਤੇਰੇ ਪੈਸੇ ਵੀਹ ਦਿਨਾਂ ਦੇ ਵਿੱਚ ਵਿੱਚ ਵਾਪਸ ਕਰ ਦਿੱਤੇ ਜਾਣਗੇ ਅਤੇ ਗੱਲ ਇਹ ਹੋਈ ਕਿ ਵੀਹ ਦਿਨ ਵੀ ਖਤਮ ਹੋ ਗਏ ਪਰੰਤੂ ਉਹਨਾਂ ਨੇ ਫਿਰ ਵੀ ਮੇਰੇ ਵਾਪਸ ਪੈਸੇ ਨਹੀਂ ਕੀਤੇ ਦੋ ਮਹੀਨਿਆਂ ਦੀ ਗੱਲ ਛੱਡੋ ਤਕਰੀਬਨ ਚਾਰ ਮਹੀਨੇ ਦਾ ਸਮਾਂ ਗੁਜ਼ਰ ਗਿਆ ਉਹਨਾਂ ਨੇ ਫਿਰ ਵੀ ਮੇਰੇ ਪੈਸੇ ਵਾਪਸ ਨਹੀਂ ਕੀਤੇ ਇਸ ਗੱਲ ਦਾ ਜ਼ਿਕਰ ਮੈਂ ਆਪਣੇ ਪੱਕੇ ਦੋਸਤ ਹਰਨੀਸ਼ ਕੋਲ ਕੀਤਾ ਅਤੇ ਹਰਨੀਸ਼ ਨੇ ਮੈਨੂੰ ਇਹ ਗੱਲ ਦੱਸੀ ਕਿ ਇਸ ਮਸਲੇ ਦਾ ਹੱਲ ਸਿਰਫ ਪੁਲਿਸ ਹੀ ਕਰ ਸਕਦੀ ਹੈ ਇਸ ਕਰਕੇ ਮੈਨੂੰ ਆਪਣੇ ਨਜ਼ਦੀਕ ਦੀ ਥਾਣਾ ਚੌਕੀ ਵਿੱਚ ਆਪਣੇ ਰਿਸ਼ਤੇਦਾਰਾਂ ਖਿਲਾਫ ਇੱਕ ਰਿਪੋਰਟ ਲਿਖਾਉਣੀ ਪਈ ਇਹ ਕੰਮ ਭਾਵੇਂ ਮੈਂ ਦਿਲ 'ਤੇ ਪੱਥਰ ਰੱਖ ਕੇ ਕੀਤਾ ਪਰੰਤੂ ਮੇਰੀ ਵੀ ਮਜ਼ਬੂਰੀ ਸੀ ਕਿਉਂਕਿ ਮੈਨੂੰ ਆਪਣੇ ਕਾਲਜ ਦੀ ਫੀਸ ਭਰਨ ਲਈ ਪੈਸਿਆਂ ਦੀ ਲੋੜ ਸੀ ਇਸ ਲਈ ਉਹਨਾਂ ਨੇ ਮੇਰੀ ਉਸ ਸਮੇਂ 'ਤੇ ਮਦਦ ਨਹੀਂ ਕੀਤੀ ਅਤੇ ਮੇਰੇ ਫੀਸ ਭਰਨ ਦੇ ਸ਼ਡਿਊਲ ਵਿੱਚ ਅੱਗੇ ਪਿੱਛੇ ਤਰੀਕ ਹੋਣ ਕਾਰਨ ਮੈਨੂੰ ਫ ਅਲੱਗ ਤੋਂ ਫਾਈਨ ਕਾਲਜ ਵਿੱਚ ਭਰਵਾਉਣਾ ਪਿਆ